ਹਾਂਜੀ ਹਾਂਜੀ ਤੁਸੀਂ ਕੌਣ ਹਾਂਜੀ ਨਹੀਂ ਫੋਨ 'ਤੇ ਗੱਲ ਤਾਂ ਨਹੀਂ ਹੋਣੀ ਤੁਹਾਨੂੰ ਆਉਣਾ ਹੀ ਪਏਗਾ ਦੱਸੋ ਤੁਹਾਨੂੰ ਕੀ ਪ੍ਰੋਬਲਮ ਕੀ ਹੈ ਤੁਸੀਂ ਜਦੋਂ ਆਜੋਗੇ ਮੈਂ ਨਾਲ ਦੀ ਨਾਲ ਮੈਮ ਨਾਲ ਮਿਲਵਾ ਦਾਂਗੀ ਤੁਹਾਨੂੰ ਪਰ ਤੁ ਤੁਹਾਨੂੰ ਪ੍ਰੋਬਲਮ ਕੀ ਹੈ ਮੈਨੂੰ ਪਹਿਲਾਂ ਸਟਾਰਟਿੰਗ ਦੱਸ ਦਿਓ ਥੋੜ੍ਹੀ ਜਿਹੀ ਹਾਂਜੀ ਠੀਕ ਹੈ ਕਿੰਨੀ ਦੇਰ ਹੋ ਗਈ ਤੁਹਾਡੇ ਇਨਫੈਕਸ਼ਨ ਆਉਂਦੇ ਨੂੰ ਠੀਕ ਹੈ ਪਰ ਤੁਹਾਨੂੰ ਪਹਿਲਾਂ ਅਲਟਰਾਸਾਊਂਡ ਕਰਵਾਉਣਾ ਪਵੇਗਾ ਅਤੇ ਸੁਵਖਤੇ ਤੁਹਾਨੂੰ ਨਾ ਖਾਲੀ ਪੇਟ ਆਉਣਾ ਪਵੇਗਾ ਹਾਂਜੀ ਹਾਂਜੀ ਨਹੀਂ ਨਹੀਂ ਪ੍ਰੈਸ਼ਰ ਜ਼ਰੂਰੀ ਹੈ ਤੁਹਾਨੂੰ ਕੱਲ੍ਹ ਸੁਬਹ ਮੋਰਨਿੰਗ ਹੀ ਆਉਣਾ ਪਵੇਗਾ ਅਤੇ ਸੁਬਹਾ ਆ ਕੇ ਪਹਿਲਾਂ ਤੁਹਾਨੂੰ ਆ ਕੇ ਨੰਬਰ ਲਗਵਾਉਣਾ ਪਵੇਗਾ ਅਗਰ ਨਹੀਂ ਆ ਸਕਦੇ ਤਾਂ ਮੈਨੂੰ ਫੋਨ ਕਰ ਦੇਣਾ ਕਿ ਮੈਂ ਆ ਅੱਜ ਕਰਵਾਉਣਾ ਅਲਟਰਾਸਾਊਂਡ ਅਤੇ ਤੁਹਾਡਾ ਨੰਬਰ ਲੱਗ ਜਾਵੇਗਾ ਠੀਕ ਐ ਹਾਂਜੀ ਹਾਂਜੀ ਪਰ ਨਾ ਤੁਸੀਂ ਕੱਲ੍ਹ ਆਉਣਾ ਨਾ ਜਦੋਂ ਸੁਬਹਾ ਮੋਰਨਿੰਗ ਮੈਨੂੰ ਇੱਕ ਵਾਰੀ ਕਾਲ ਕਰ ਲੈਣਾ ਅਤੇ ਤੁਹਾਨੂੰ ਲਿਆਉਣਾ ਪਵੇਗਾ ਆਧਾਰ ਕਾਰਡ ਵੋਟਰ ਕਾਰਡ ਦੋ ਚੀਜ਼ਾਂ ਲਿਆਉਣੀਆਂ ਪੈਣਗੀਆ ਤੁਹਾਡਾ ਵੀ ਲਿਆਉਣਾ ਪਵੇਗਾ ਅਤੇ ਤੁਹਾਡੇ ਹਸਬੈਂਡ ਦਾ ਵੀ ਲਿਆਉਣਾ ਪਵੇਗਾ ਚਲ ਤਾਂ ਜਾਂਦਾ ਪਰ ਚਲੋ ਤੁਸੀਂ ਉਹਦੀ ਫੋਟੋਸਟੇਟ ਲੈ ਆਉਣਾ ਆਧਾਰ ਕਾਰਡ ਰਿਜਨਲ ਨਾ ਲਿਆਉਣਾ ਫੋਟੋਸਟੇਟ ਲੈ ਆਉਣਾ ਉਹਦੇ ਨਾਲ ਆਪਣਾ ਹੋ ਜਾਵੇਗਾ ਕੰਮ ਤੁਹਾਡੇ ਹਸਬੈਂਡ ਦੇ ਓਰਿਜਨਲ ਜ਼ਰੂਰ ਲੈ ਆਉਣਾ ਤੁਹਾਡੀ ਫੋਟੋ ਕਾਪੀ ਨਾਲ ਚਲ ਜਾਵੇਗਾ ਠੀਕ ਹੈ ਉਹ ਫੋਨ ਵਿੱਚ ਪਿੱਕ ਤੋਂ ਹੋਏਗੀ ਫੋਟੋਸਟੇਟ ਦੀ ਪਿੱਕ ਤਾਂ ਹੋਵੇਗੀ ਕਲਿੱਕ ਹੋਵੇਗੀ ਨਹੀਂ ਜੀ ਨਹੀਂ ਨਹੀਂ ਤੁਸੀਂ ਫੋਨ ਹੀ ਸਾਨੂੰ ਦੇ ਦੇਣਾ ਇੱਥੋਂ ਨਿਕਲਵਾ ਦਾਂਗੇ ਹਾਂਜੀ ਫੋਨ 'ਤੇ ਹੀ ਨਿਕਾਲ ਦਾਂਗੇ ਤੁਹਾਡਾ ਆਧਾਰ ਕਾਰਡ ਦਾ ਅਤੇ ਅਗਰ ਤੁਸੀਂ ਆਓਗੇ ਤਾਂ ਬਾਥਰੂਮ ਦਾ ਪ੍ਰੈਸ਼ਰ ਬਹੁਤ ਜ਼ਰੂਰੀ ਹੈ ਖਾ ਪੀ ਕੇ ਕੁਛ ਨਾ ਆਉਣਾ ਅਗਰ ਖਾਣਾ ਹੋਵੇ ਤਾਂ ਲਿਕੁਇਡ ਪਾਣੀ ਜਾਂ ਥੋੜ੍ਹੀ ਬਹੁਤ ਟੀਅ ਜਾਂ ਮਤਲਬ ਕਿ ਦੁੱਧ ਵਗੈਰਾ ਲੈ ਲੈਣਾ ਅਤੇ ਕੁਛ ਨਾਲ ਚੀਜ਼ ਨਾ ਲੈਣਾ ਬਿਸਕਿਟ ਵਗੈਰਾ ਮਤ ਖਾਣਾ ਤੁਹਾਨੂੰ ਨਾ ਕਾਲ ਕਰ ਦੇਵਾਂਗੇ ਕੱਲ੍ਹ ਡਾਕਟਰ ਸਾਹਿਬ ਤਾਂ ਦਸ ਵਜੇ ਬੈਠਦੇ ਨੇ ਅਤੇ ਉਦੋਂ ਆਉਂਦੇ ਹੀ ਪਹਿਲਾਂ ਦੋ ਤਿੰਨ ਪੇਸ਼ੈਂਟ ਦੇਖਦੇ ਨੇ ਫਿਰ ਉਹ ਸਟਾਰਟ ਕਰ ਲੈਂਦੇ ਨੇ ਅਲਟਰਾਸਾਊਂਡ ਦਾ ਅਤੇ ਤੁਸੀਂ ਦਸ ਵਜੇ ਹੀ ਆ ਜਾਣਾ ਦਸ ਵਜੇ ਆ ਜਾਣਾ ਤੁਹਾਡਾ ਸਾਰਿਆਂ ਨਾਲੋਂ ਪਹਿਲਾਂ ਤੁਹਾਡਾ ਹੀ ਚੈਕਅਪ ਕਰਵਾ ਕੇ ਅਤੇ ਅਲਟਰਾਸਾਊਂਡ ਕਰਵਾਉਣਾ ਹੀ ਪਵੇਗਾ ਤੁਹਾਨੂੰ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਜੀ ਜਿੰਨਾ ਹੋ ਸਕੇ ਸੁਬਹਾ ਉੱਠ ਕੇ ਪਾਣੀ ਦੇ ਇੱਕ ਇੱਕ ਦੋ ਇੱਕ ਚਾਰ ਗਿਲਾਸ ਪੀ ਲੈਣਾ ਤਾਂ ਹੀ ਪ੍ਰੈਸ਼ਰ ਬਣੇਗਾ ਅਗਰ ਨੀਡ ਪਈ ਤਾਂ ਕੋਈ ਨਹੀਂ ਤੁਹਾਨੂੰ ਇੱਕ ਟੈਬਲੇਟ ਵੀ ਦੇ ਦਾਂਗੇ ਉਹਦੇ ਨਾਲ ਪ੍ਰੈਸ਼ਰ ਵੀ ਬਣ ਜਾਂਦਾ ਠੀਕ ਹੈ ਜੀ ਓਕੇ ਜੀ